ਭੰਗੜਾ ਪੰਜਾਬ ਦਾ ਸੱਭਿਆਚਾਰਕ ਲੋਕ ਨਾਚ ਹੈ ਭੰਗੜੇ ਦੇ ਕੁਛ ਆਮ ਸਟੈਪ ਹਨ ਭੰਗੜਾ ਇੱਕ ਇਹ ਜਿਹਾ ਨਾਚ ਹੈ ਜਿਸ ਵਿੱਚ ਸਰੀਰ ਦੇ ਹਰ ਹਰਕਤ ਖੁਸ਼ੀ ਅਤੇ ਜੋਸ਼ ਨਾਲ ਭਰੀ ਹੁੰਦੀ ਹੈ ਇਸ ਦੇ ਸਟੈਪ ਬਹੁਤ ਸਾਰੇ ਹਨ ਸਮੇਂ ਅਤੇ ਥਾਂ ਦੇ ਨਾਲ ਨਾਲ ਬਦਲਦੇ ਰਹਿੰਦੇ ਹਨ ਹਲ ਹਾਲਾਂਕਿ ਕੁਝ ਆਮ ਸਟੈਪ ਹਨ ਜੋ ਹਰ ਭੰਗੜੇ ਵਿੱਚ ਲੱਭੇ ਜਾ ਸਕਦੇ ਹਨ ਭੰਗੜੇ ਦੇ ਕੁਛ ਆਮ ਸਟੈਪ ਤਾੜੀਆਂ ਤਾੜੀਆਂ ਭੰਗੜੇ ਦਾ ਅਨਿਖੜਵਾਂ ਅੰਗ ਹੈ ਇਹ ਨਾ ਸਿਰਫ ਤਾਲ ਨੂੰ ਬਣਾਈ ਰੱਖਦੀਆਂ ਹਨ ਸਗੋਂ ਨੱਚਣ ਵਾਲਿਆਂ ਨੂੰ ਇੱਕ ਦੂਜੇ ਨਾਲ ਜੋੜਨ ਦਾ ਕੰਮ ਵੀ ਕਰਦੀਆਂ ਹਨ ਪੈਰਾਂ ਦੀ ਘੁੰਮਾਵ ਭੰਗੜੇ ਵਿੱਚ ਪੈਰਾਂ ਨੂੰ ਤੇਜ਼ੀ ਨਾਲ ਘੁਮਾਇਆ ਜਾਂਦਾ ਹੈ ਇਹ ਸਟੈਪ ਭੰਗੜੇ ਨੂੰ ਜੋਸ਼ ਨਾਲ ਭਰ ਦਿੰਦਾ ਹੈ ਹੱਥਾਂ ਦੀਆਂ ਹਰਕਤਾਂ ਭੰਗੜੇ ਵਿੱਚ ਹੱਥਾਂ ਦੀਆਂ ਵੀ ਬਹੁਤ ਸਾਰੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ ਇਹ ਹਰਕਤਾਂ ਨਾਚ ਨੂੰ ਹੋਰ ਵੀ ਰੰਗੀਨ ਬਣਾਉਂਦੀਆਂ ਹਨ ਸਰੀਰ ਨੂੰ ਹਿਲਾਉਣਾ ਭੰਗੜੇ ਵਿੱਚ ਸਾਰੇ ਸਰੀਰ ਨੂੰ ਹਿਲਾਇਆ ਜਾਂਦਾ ਹੈ ਇਸ ਵਿੱਚ ਕਮਰ ਨੂੰ ਹਿਲਾਉਣਾ ਮੋਢੇ ਨੂੰ ਹਿਲਾਉਣਾ ਅਤੇ ਸਿਰ ਨੂੰ ਹਿਲਾਉਣਾ ਸ਼ਾਮਿਲ ਹੈ ਭੰਗੜੇ ਦੇ ਸਟੈਪ ਅਤੇ ਪੰਜਾਬੀ ਸੱਭਿਆਚਾਰ ਭੰਗੜੇ ਦੇ ਸਟੈਪ ਪੰਜਾਬੀ ਸੱਭਿਆਚਾਰ ਦੇ ਜੋਰਦਾਰ ਅਤੇ ਜਸ਼ਨ ਵਾਲੇ ਸੁਭਾਅ ਨੂੰ ਬਹੁਤ ਵਧੀਆ ਤਰੀਕੇ ਨਾਲ ਦਰਸਾਉਂਦੇ ਹਨ ਜੋਸ਼ ਅਤੇ ਉਤਸ਼ਾਹ ਭੰਗੜੇ ਦੇ ਅਤੇ ਸਟੈਪ ਅਤੇ ਤਾੜੀਆਂ ਨੱਚਣ ਵਾਲਿਆਂ ਵਿੱਚ ਜੋਸ਼ ਅਤੇ ਉਤਸ਼ਾਹ ਪੈਦਾ ਕਰਦੀਆਂ ਹਨ ਇਹ ਪੰਜਾਬੀਆਂ ਦੇ ਜੋਸ਼ੀਲੇ ਸੁਭਾਅ ਨੂੰ ਦਰਸਾਉਂਦਾ ਹੈ ਖੁਸ਼ੀ ਭੰਗੜੇ ਦੇ ਹਰ ਸਟੈਪ ਵਿੱਚ ਖੁਸ਼ੀ ਝਲਕਦੀ ਹੈ ਇਹ ਪੰਜਾਬੀਆਂ ਦੇ ਜੀਵਨ ਨੂੰ ਖੁਸ਼ੀ ਨਾਲ ਜੀਣ ਦੇ ਤਰੀਕੇ ਦਰਸਾਉਂਦਾ ਹੈ ਸਰਲਤਾ ਭੰਗੜੇ ਦੇ ਸਟੈੱਪ ਬਹੁਤ ਸਰਲ ਹੁੰਦੇ ਹਨ ਇਹ ਕਿਸੇ ਵੀ ਉਮਰ ਦੇ ਵਿਅਕਤੀ ਦੁਆਰਾ ਸਿੱਖੇ ਜਾ ਸਕਦੇ ਹਨ ਇਹ ਪੰਜਾਬੀਆਂ ਦੀ ਸਰਲਤਾ ਨੂੰ ਦਰਸਾਉਂਦੇ ਹਨ